ਯੋਗਾ ਮੇਰੇ ਸਿਹਤ ਲਈ ਬਹੁਤ ਉਪਯੋਗੀ ਹੈ ਮੈਂ ਜਦੋਂ ਬਹੁਤ ਛੋਟੀ ਸੀ ਤਾਂ ਵੀ ਬਚਪਨ ਵਿੱਚ ਯੋਗਾ ਸਿੱਖਣ ਜਾਂਦੀ ਸੀ ਅਤੇ ਧੀਰੇ ਧੀਰੇ ਮੈਂ ਯੋਗਾ ਨੂੰ ਇੰਨਾ ਜ਼ਿਆਦਾ ਕਰਨਾ ਸ਼ੁਰੂ ਕਰਤਾ ਕਿ ਮੈਂ ਵੱਡੀਆਂ ਵੱਡੀਆਂ ਆਂਟੀਆਂ ਨੂੰ ਸਿਖਾਉਣਾ ਸ਼ੁਰੂ ਕਰਤਾ ਮੇਰੀਆਂ ਅੱਖਾਂ ਦਾ ਨੰਬਰ ਲਗਭਗ ਪੰਜ ਤੋਂ ਜ਼ਿਆਦਾ ਸੀਗਾ ਅਤੇ ਮੈਂ ਰੋਜ਼ ਸਵੇਰੇ ਉੱਠ ਕੇ ਪੰਜ ਵਜੇ ਯੋਗਾ ਕੀਤੀ ਨਾਲ ਉਹਦੇ ਮੈਂ ਨੇਤਰੀ ਕੀਤੀ ਜਿਹਦੇ ਨਾਲ ਧੀਰੇ ਧੀਰੇ ਮੇਰਾ ਨੰਬਰ ਘੱਟ ਹੋਣਾ ਸ਼ੁਰੂ ਹੋ ਗਿਆ ਅਤੇ ਇੱਕ ਟਾਈਮ ਇੱਦਾਂ ਆਇਆ ਕਿ ਮੇਰਾ ਨੰਬਰ ਬਿਲਕੁਲ ਹੀ ਜ਼ੀਰੋ ਹੋ ਗਿਆ ਯੋਗਾ ਅੱਖਾਂ ਲਈ ਬਹੁਤ ਜ਼ਰੂਰੀ ਸੀ ਮੈਂ ਸਵੇਰੇ ਉੱਠਦੇ ਹੀ ਨੰਗੇ ਪੈਰ ਘਾਹ 'ਤੇ ਚੜ੍ਹਦੀ ਸੀ ਅਤੇ ਨਾਲ ਨਾਲ ਨੇਤਰੀ ਕਰਦੀ ਉਸ ਕਾਰਨ ਮੇਰੇ ਅੰਦਰੂਨੀ ਬਿਮਾਰੀਆਂ ਖਤਮ ਹੋਣ ਦੇ ਕਾਰਨ ਮੇਰਾ ਨੰਬਰ ਸਿਫਰ ਹੋ ਗਿਆ ਉਸ ਤੋਂ ਬਾਅਦ ਮੈਂ ਲਗਾਤਾਰ ਪੂਰੀ ਜ਼ਿੰਦਗੀ ਯੋਗਾ ਨੂੰ ਅਪਣਾ ਹਿੱਸਾ ਬਣਾਇਆ ਅਤੇ ਰੋਜ਼ ਸਵੇਰੇ ਇੱਕ ਘੰਟਾ ਉੱਠ ਕੇ ਮੈਂ ਯੋਗਾ ਕਰਦੀ ਹਾਂ ਚਾਹੇ ਜੋ ਮਰਜ਼ੀ ਹੋ ਜਾਵੇ ਮੈਂ ਜਿੱਥੇ ਮਰਜ਼ੀ ਗਈ ਹੋਵਾਂ ਮੈਂ ਉੱਠਦੇ ਸਾਰ ਹੀ ਯੋਗਾ ਕਰਨਾ ਅਤੇ ਨੰਗੇ ਪੈਰ ਘਾਹ ਉੱਤੇ ਚੜ੍ਹਨਾ ਹੈ ਇਹ ਅੱਖਾਂ ਲਈ ਬਹੁਤ ਹੀ ਜ਼ਿਆਦਾ ਉਪਯੋਗੀ ਹੈ ਅੱਖ ਸਾਡੇ ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਹੈ ਜੇ ਸਾਡੀਆਂ ਅੱਖਾਂ ਠੀਕ ਹੈ ਤਾਂ ਅਸੀਂ ਜ਼ਿੰਦਗੀ ਵਿੱਚ ਚੱਲ ਫਿਰ ਸਕਦੇ ਹਾਂ ਅਤੇ ਇਹ ਯੋਗਾ ਨੇ ਹੀ ਮੇਰੀ ਅੱਖਾਂ ਨੂੰ ਇੰਨੇ ਨੰਬਰ ਤੋਂ ਪੰਜ ਨੰਬਰ ਤੋਂ ਸਿਫਰ ਕਰ ਦਿੱਤਾ ਜੇ ਮੈਂ ਯੋਗਾ ਨਾ ਕੀਤੀ ਹੁੰਦੀ ਤਾਂ ਅੱਜ ਮੇਰਾ ਨੰਬਰ ਹੋਰ ਵਧਿਆ ਹੋਣਾ ਸੀ ਇਸ ਲਈ ਮੈਂ ਸਭ ਨੂੰ ਕਹਿੰਦੀ ਹਾਂ ਕਿ ਯੋਗਾ ਨੂੰ ਆਪਣਾ ਹਿੱਸਾ ਜ਼ਰੂਰ ਬਣਾਓ ਅਤੇ ਇਸ ਦਾ ਫਾਇਦਾ ਬਣਾਓ ਇਹ ਸਾਨੂੰ ਸਰੀਰਕ ਤੌਰ 'ਤੇ ਤਾਂ ਫਾਇਦਾ ਦਿੰਦਾ ਹੀ ਹੈ ਨਾਲ ਨਾਲ ਇਹ ਸਾਨੂੰ ਮਾਨਸਿਕ ਤੌਰ 'ਤੇ ਵੀ ਫਰੈਸ਼ ਕਰਦਾ ਹੈ